ਹੈਲੋ ਹੋਰ ਜੀ ਅਸੀਂ ਤੁਹਾਡੇ ਨਵੇਂ ਨੇਬਰਸ ਬੋਲਦੇ ਹਾਂ ਜਿਹੜੇ ਅਸੀਂ ਕੱਲ੍ਹ ਹੀ ਸ਼ਿਫਟ ਹੋਏ ਹਾਂ ਮੈਂ ਖੁਸ਼ੀ ਅਸੀਂ ਤੁਹਾਡਾ ਨੰਬਰ ਲਿਆ ਸੀ ਹਾਂਜੀ ਉਹ ਮੈਂ ਤੁਹਾਡੇ ਤੋਂ ਪੁੱਛਣਾ ਸੀ ਮੈਨੂੰ ਨਾ ਇੱਥੇ ਥੋੜ੍ਹੀ ਦਿੱਕਤ ਆ ਰਹੀ ਕਿਉਂਕਿ ਮੈਨੂੰ ਇੱਥੋਂ ਬਾਰੇ ਕੁਝ ਪਤਾ ਨਹੀਂ ਹੈਗਾ ਮੈਂ ਪੁੱਛਣਾ ਸੀ ਇਥੋਂ ਫਰੈਸ਼ ਸਬਜ਼ੀਆਂ ਕਿਵੇਂ ਮਿਲਦੀਆਂ ਕਿੱਥੋਂ ਮਿਲਦੀਆਂ ਇੱਥੋਂ ਹਾਂਜੀ ਅੱਛਾ ਜੀ ਹਾਂਜੀ ਮੈਂ ਵੀ ਸੁਣਿਆ ਸੀਗਾ ਵੀ ਸਾਨੂੰ ਭਾਗ ਬਹੁਤ ਸਸਤੇ ਹੋ ਜਾਂਦੇ ਕਿਉਂਕਿ ਉਹਨਾਂ ਨੇ ਹੁਣ ਆਪਦੇ ਖਤਮ ਕਰਨਾ ਹੁੰਦਾ ਸਟੋਕ ਹਾਂਜੀ ਜੀ ਮੈਂ ਇੱਥੇ ਜਮ੍ਹਾਂ ਨਵੀਂ ਹੈਗੀ ਹੈ ਮੈਨੂੰ ਰਸਤੇ ਵਗੈਰਾ ਨਹੀਂ ਪਤਾ ਕੀ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਮੰਡੀ ਠੀਕ ਹੈ ਜੀ ਆਪਾਂ ਕੱਲ੍ਹ ਚੱਲੀਏ ਸੁਬਹਾ ਸੁਬਹਾ ਤਾਂ ਕਿ ਆਪਾਂ ਸ਼ੋਪਿੰਗ ਕਰ ਲਈਏ ਸਬਜ਼ੀਆਂ ਦੀ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਓਕੇ ਜੀ